ਸਾਡੇ ਪਿੰਡ ਬੈਂਕ ਵਿੱਚ ਹੀ ਇੱਕ ਏ ਟੀ ਐਮ ਬਣਿਆ ਹੋਇਆ ਹੈ ਜਿਸ ਵਿੱਚੋਂ ਅਸੀਂ ਪੈਸੇ ਕਢਵਾਉਂਦੇ ਰਹਿੰਦੇ ਹਾਂ ਇਹ ਏ ਟੀ ਐਮ ਜ਼ਿਆਦਾਤਰ ਜਾਂ ਤਾਂ ਖਰਾਬ ਹੁੰਦਾ ਹੈ ਜਾਂ ਕਈ ਵਾਰ ਇਸ ਵਿੱਚ ਨਗਦੀ ਹੀ ਨਹੀਂ ਹੁੰਦੀ ਕਈ ਵਾਰ ਸਾਡਾ ਏ ਟੀ ਐਮ ਕਾਰਡ ਜਾਂ ਪੈਸੇ ਹੀ ਇਸ ਵਿੱਚ ਫਸ ਜਾਂਦੇ ਹਨ ਜਿਸ ਕਰਕੇ ਸਾਨੂੰ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਜਦੋਂ ਏ ਟੀ ਐਮ ਨਹੀਂ ਚਲਦਾ ਤਾਂ ਸਾਨੂੰ ਦੂਰ ਦੁਰਾਡੇ ਪਿੰਡਾਂ ਵਿੱਚ ਜਾ ਕੇ ਪੈਸੇ ਕਢਾਉਣੇ ਪੈਂਦੇ ਹਨ ਜਿੱਥੇ ਆਉਣਾ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਸਾਡੇ ਪਿੰਡਾਂ ਵਿੱਚੋਂ ਬੱਸਾਂ ਵੀ ਬਹੁਤ ਘੱਟ ਜਾਂਦੀਆਂ ਹਨ ਇੱਕ ਲਈ ਪੈਸੇ ਕਢਵਾਉਣ ਦੀ ਲੀਮਟ ਹੁੰਦੀ ਹੈ ਜ਼ਿਆਦਾ ਕਈ ਵਾਰ ਸਾਨੂੰ ਜ਼ਿਆਦਾ ਪੈਸਿਆਂ ਦੀ ਲੋੜ ਹੁੰਦੀ ਹੈ ਇਸ ਕਰਕੇ ਸਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਤਾਂ ਪੈਸੇ ਆਪ ਤਾਂ ਅਸੀਂ ਜ਼ਿਆਦਾ ਕਢਵਾ ਸਕਦੇ ਹੋਈਏ ਇਸ ਤਰ੍ਹਾਂ ਬੈਂਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਏ ਟੀ ਐਮ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਉਸਦਾ ਟਾਈਮ ਸਮੇਂ ਸਿਰ ਖੋ ਖੋਲ੍ਹਿਆ ਜਾਣਾ ਚਾਹੀਦਾ ਹੈ